ਮੈਂ ਚੰਡੀਗੜ੍ਹ ਸਟੱਡੀ ਅਤੇ ਜੌਬ ਕਰਦਾ ਹਾਂ ਓ ਜੋ ਕਿ ਮੇਰੇ ਔਡਰ ਸਵਿਗੀ ਜਾਂ ਜੌਮੈਟੋ ਤੋਂ ਮੈਂ ਕਰਦਾ ਹਾਂ ਮੇਰੇ ਕੋਲ ਰੋਟੀ ਲੰਚ ਡਿਨਰ ਜਾਂ ਬ੍ਰੇਕਫਾਸਟ ਬਣਾਉਣ ਲਈ ਮੇਰੇ ਕੋਈ ਟੈਮ ਨਹੀਂ ਹੁੰਦਾ ਇਸ ਕਰਕੇ ਮੈਂ ਔਨਲਾਈਨ ਕਰ ਦਿੰਦਾ ਹਾਂ ਔਰ ਔਰ ਮੈਨੂੰ ਸ਼ੌਂਕ ਵੀ ਬਹੁਤ ਹੈ ਕਿ ਔਨਲਾਈਨ ਚੀਜ਼ਾਂ ਖਾਵਾਂ ਹੈ ਨਾ ਇੱਕ ਤਾਂ ਬੰਦਾ ਆਪ ਬਣਾਉਂਦਾ ਤਾਂ ਬਣਾਉਣ ਲਈ ਫਿਰ ਟੈਮ ਨਹੀਂ ਹੁੰਦਾ ਕਿਉਂਕਿ ਮੈਂ ਇਸ ਕਰਕੇ ਔਨਲਾਈਨ ਔਡਰ ਕਰ ਦਿੰਦਾ ਹਾਂ ਅਤੇ ਹਾਂ ਬਹੁਤ ਵਧੀਆ ਖਾਣਾ ਵੀ ਹੁੰਦਾ ਹੈ ਪਰ ਕਈ ਵਾਰ ਮੈਂ ਔਡਰ ਕੀਤਾ ਮੇਰੇ ਪੈਸੇ ਨਹੀਂ ਕੱਟ ਹੋਏ ਉਹ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਮੇਰੇ ਪੈਸੇ ਕਾਹਤੇ ਨਹੀਂ ਕੱਟ ਹੋਏ ਐਪ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੇਰੇ ਪੈਸੇ ਕਾਹਤੇ ਨਹੀਂ ਕੱਟ ਹੋਏ ਮੈਂ ਗੂਗਲ ਪੇ ਜਾਂ ਅਕਾਊਂਟ 'ਚੋਂ ਪੈਸੇ ਟ੍ਰਾਂਸਫਰ ਕਰ ਦਿੰਦਾ ਹਾਂ ਅਤੇ ਜੌਮੈਟੋ ਵਾਲੇ ਸਰਵਿਸ ਵੀ ਵਧੀਆ ਹੁੰਦੀ ਹੈ ਅਤੇ ਸਵੀਮਿੰਗ ਵਾਲਿਆ ਦੀ ਔਰ ਜੌਮੈਟੋ ਵਾਲਿਆਂ ਦੀ ਸਰਵਿਸ ਬਹੁਤ ਘੈਂਟ ਹੈ ਜਲਦੀ ਤੋਂ ਜਲਦੀ ਪੁੱਜਾ ਦਿੰਦੇ ਹਨ ਅਤੇ ਮੈਂ ਇਹ ਪਤਾ ਕਰਨਾ ਚਾਹ ਰਿਹਾ ਕਿ ਮੇਰੇ ਪੈਸੇ ਕਿਉਂ ਨਹੀਂ ਕੱਟ ਹੋਏ ਵੀ ਮੇਰੇ ਅਕਾਊਂਟ ਵੀ ਚੈੱਕ